ਜੇਕਰ ਮੈਂ ਗੱਲ ਕਰਾਂ ਮੇਰੇ ਮਨਪਸੰਦ ਰਾਜ ਦੀ ਤਾਂ ਪੰਜਾਬ ਮੇਰਾ ਮਨਪਸੰਦ ਰਾਜ ਹੈ ਮੈਂ ਬਾਕੀਆਂ ਨੂੰ ਬੁਰਾ ਨਹੀਂ ਬੋਲਦਾ ਪਰ ਯਾਰ ਪੰਜਾਬ ਦੇ ਲੋਕ ਨਾ ਬਹੁਤ ਇਕੱਠੇ ਹੋ ਕੇ ਰਹਿੰਦੇ ਨੇ ਅਤੇ ਇੱਥੇ ਦਾ ਭਾਈਚਾਰਾ ਬਹੁਤ ਮੰਨਿਆ ਗਿਆ ਜੇਕਰ ਮਦਦ ਦੀ ਵੀ ਲੋੜ ਹੋਵੇ ਨਾ ਤਾਂ ਪੰਜਾਬੀ ਇੱਕ ਦੂਜੇ ਦੀ ਸਾਰੇ ਰਲ ਕੇ ਮਦਦ ਕਰਦੇ ਨੇ ਅਤੇ ਪੰਜਾਬੀ ਸੱਭਿਆਚਾਰ ਤਾਂ ਪੂਰੀ ਦੁਨੀਆਂ ਵਿੱਚ ਹੀ ਮੰਨਿਆ ਗਿਆ ਤਾਂ ਪੰਜਾਬੀ ਸੱਭਿਆਚਾਰ ਉਹਨਾਂ ਦੀ ਪੜ੍ਹਾਈ ਵਿੱਚ ਵੀ ਦਿਖਦਾ ਹੈ ਅਤੇ ਗਿੱਧਿਆਂ ਅਤੇ ਭੰਗੜਾ ਤਾਂ ਪੰਜਾਬ ਦੀ ਸ਼ਾਨ ਨੇ ਪੰਜਾਬ ਦੇ ਵਿੱਚ ਹਰੇਕ ਤੀਜ਼ ਤਿਉਹਾਰ 'ਤੇ ਪੰਜਾਬੀ ਲੋਕ ਗਿੱਧਾ ਅਤੇ ਭੰਗੜਾ ਪਾਉਂਦੇ ਨੇ ਅਤੇ ਜੇਕਰ ਮੈਂ ਆਪਣੇ ਮਨਪਸੰਦ ਜਗ੍ਹਾ ਘੁੰਮਣ ਦੀ ਗੱਲ ਕਰਾਂ ਤਾਂ ਉਹ ਤਾਂ ਬਈ ਸ਼ਿਮਲਾ ਅਤੇ ਮਨਾਲੀ ਹੈ ਕਿਉਂਕਿ ਉਸ ਤੋਂ ਵੱਧ ਕੇ ਹੋਰ ਸੋਹਣੀ ਥਾਂ ਤਾਂ ਮੈਂ ਦੇਖੀ ਹੀ ਨਹੀਂ ਕਦੇ ਕਿਉਂਕਿ ਉਹਨਾਂ ਦਾ ਇੱਕ ਸਵੱਛ ਵਾਤਾਵਰਣ ਅਤੇ ਇੱਕ ਉਹਨਾਂ ਦੇ ਤਿੱਖੇ ਤਿੱਖੇ ਮੋੜ ਅਤੇ ਪਹਾੜਾਂ ਦੀ ਸੁੰਦਰ ਦ੍ਰਿਸ਼ ਇਹ ਮੈਨੂੰ ਬਹੁਤ ਵਧੀਆ ਲੱਗਦੇ ਨੇ ਅਤੇ ਮੈਂ ਉੱਥੇ ਵਾਰ ਵਾਰ ਘੁੰਮਣਾ ਚਾਹੂੰਗਾ